ਜੀ ਹਾਂ ਮੇਰੇ ਕੋਲ ਆਪਣੀਆਂ ਮਨ ਪਸੰਦ ਕਿਤਾਬਾਂ ਦੀ ਇੱਕ ਲੜੀ ਹੈ ਅਤੇ ਇਸ ਦੇ ਵਿੱਚ ਵਧੇਰੇ ਕਰਕੇ ਨਾਵਲ ਅਤੇ ਕਵਿਤਾਵਾਂ ਹਨ ਇਹ ਨਾਵਲ ਅਤੇ ਕਵਿਤਾਵਾਂ ਦੀ ਲੜੀ ਮੈਂ ਇਸ ਕਰਕੇ ਬਣਾਈ ਹੈ ਕਿਉਂ ਕਰਕੇ ਇਹ ਕਿਤਾਬਾਂ ਪੜ੍ਹਨ ਵੇਲੇ ਮੇਰੇ ਮਨ ਨੂੰ ਸਭ ਤੋਂ ਵੱਧ ਸਕੂਨ ਦਿੰਦੀ ਹਨ ਨਾਵਲ ਨੇ ਜਿਨ੍ਹਾਂ ਨੂੰ ਪੜ੍ਹ ਕੇ ਮੈਂ ਹਮੇਸ਼ਾ ਕਿਸੇ ਫਿਲਮ ਵਾਂਗੂ ਮਹਿਸੂਸ ਕੀਤਾ ਹੈ ਜਦੋਂ ਕਿ ਜਿਹੜੀਆਂ ਕਵਿਤਾਵਾਂ ਹਨ ਉਹ ਮੈਨੂੰ ਕਿਸੇ ਹੋਰ ਦੁਨੀਆਂ ਦੇ ਵਿੱਚ ਲੈ ਜਾਂਦੀਆਂ ਹਨ ਅਤੇ ਬਹੁਤ ਹੀ ਸੂਖਮ ਅਤੇ ਆਨੰਦ ਭਰਪੂਰ ਅਹਿਸਾਸ ਮੈਨੂੰ ਦਿੰਦੀਆਂ ਹਨ ਇਸ ਕਰਕੇ ਕਵਿਤਾਵਾਂ ਪੜ੍ਹਨਾ ਅਤੇ ਨਾਵਲ ਪੜ੍ਹਨਾ ਮੈਨੂੰ ਸਭ ਤੋਂ ਵੱਧ ਚੰਗਾ ਲੱਗਦਾ ਹੈ ਅਤੇ ਇਹੋ ਕਿਤਾਬਾਂ ਮੇਰੀਆਂ ਮਨ ਪਸੰਦ ਕਿਤਾਬਾਂ ਦੀ ਲੜੀ ਵਿੱਚ ਆਉਂਦੀਆਂ ਹਨ ਇਸ ਤੋਂ ਇਲਾਵਾਂ ਮੈਂ ਸਾਹਿਤ ਨਾਲ ਸੰਬੰਧਿਤ ਹੋਰ ਕਿਤਾਬਾਂ ਵੀ ਪੜ੍ਹਦਾ ਰਹਿੰਦਾ ਹਾਂ ਧੰਨਵਾਦ